ਰਾਜ ਸਰਕਾਰ ਫੈਸਲੇ ਸਹੀ ਲੈਂਦੇ ਰਾਜ ਸਰਕਾਰ ਰਾਜ ਸਰਕਾਰ ਨੇ ਪੰਜਾਬ ਦੇ ਵਿੱਚ ਕਈ ਸ਼ਿਕਾਇਤ ਕੇਂਦਰ ਬਣਾਏ ਉੱਥੇ ਤੁਸੀਂ ਜਾ ਕੇ ਆਪਣੀ ਸ਼ਿਕਾਇਤ ਦਰਜ ਕਰ ਸਕਦੇ ਉਹ ਦੋ ਹਫਤੇ ਦੇ ਵਿੱਚ ਤੁਹਾਡੀ ਸ਼ਿਕਾਇਤ ਹੱਲ ਕਰ ਦਿੰਦੀ ਹੈ ਰਾਜ ਸਰਕਾਰ ਫੈਸਲੇ ਦੇ ਵਿੱਚ ਸਭ ਕੁਝ ਬਹੁਤ ਜ਼ਿਆਦਾ ਜਲਦੀ ਜਲਦੀ ਫੈਸਲੇ ਦਿੰਦੀ ਹੈ ਜਿਸ ਕਾਰਨ ਲੋਕਾਂ ਨੂੰ ਮੁਸ਼ਕਲ ਨਹੀਂ ਆਉਂਦੀ ਉਹਨਾਂ ਨੇ ਕਈਆਂ ਕਈ ਲੋਕਾਂ ਦੀਆਂ ਸਮੱਸਿਆਵਾਂ ਹੱਲ ਕੀਤੀਆਂ ਹਨ ਉਹ ਜਨਤਾ ਨੂੰ ਜ਼ਿਆਦਾ ਪਰੇਸ਼ਾਨ ਨਹੀਂ ਕਰਦੀ ਹੈਗੀ ਰਾਜ ਸਰਕਾਰ ਪਾਣੀ ਦੀ ਜਿਵੇਂ ਸਮੱਸਿਆ ਹੋਈ ਸੀਵਰੇਜਾਂ ਦੀ ਸਮੱਸਿਆ ਹੋਈ ਉਹਨਾਂ ਨੂੰ ਹੱਲ ਕਰਵਾਇਆ ਹੋਇਆ ਹੈ ਪਾਣੀ ਦੀ ਸਮੱਸਿਆ ਲਈ ਨਵੀਆਂ ਪਾਈਪਾਂ ਪਾ ਕੇ ਉਹਨਾਂ ਨੇ ਪਾਣੀ ਦੀ ਸਮੱਸਿਆ ਨਵੀਂ ਜਗ੍ਹਾ 'ਤੇ ਟਿਊਬੈੱਲ ਲਗਾ ਕੇ ਉਹਨਾਂ ਨੇ ਨਵੇਂ ਟਿਊਬੈੱਲ ਲਗਾਏ ਹੋਏ ਹੈ ਉਹਨਾਂ ਨੇ ਸੀਵਰੇਜਾਂ ਦੇ ਵੀ ਸਮੱਸਿਆ ਨੂੰ ਬੜੀ ਜਲਦੀ ਹੱਲ ਕੀਤਾ ਜੇ ਕੋਈ ਹੋਰ ਵੀ ਹੈ ਤਾਂ ਵੀ ਉਹ ਜਲਦੀ ਹੱਲ ਕਰ ਦਿੰਦੀ ਲੋਕਾਂ ਨੂੰ ਦੂਰ ਦਰਾਜ ਤੱਕ ਨਹੀਂ ਜਾਣਾ ਪੈਂਦਾ ਹੈ ਉਹ ਜਲਦੀ ਜਲਦੀ ਲੋਕਾਂ ਦੀਆਂ ਮੁਸੀਬਤਾਂ ਨੂੰ ਹੱਲ ਕਰ ਲੈਂਦੀ ਫੈਸਲੇ ਲੈ ਲੈਂਦੀ ਹੈ ਜਿਸ ਕਾਰਨ ਲੋਕਾਂ ਨੂੰ ਕੋਈ ਮੁਸ਼ਕਲ ਨੇੜੇ ਨੇੜੇ ਉਹਨਾਂ ਨੇ ਲੋਕਾਂ ਦੇ ਘਰਾਂ ਦੇ ਨੇੜੇ ਹੀ ਕਾਨੂੰਨ ਉਹ ਬਣਾਏ ਹੋਏ ਹਨ ਸੁਵਿਧਾ ਕੇਂਦਰ ਬਣਾਏ ਹੋਏ ਜਿੱਥੇ ਜਾ ਕੇ ਆਪਾਂ ਫੈ ਦੱਸਦੇ ਹਾਂ ਕਿ ਸਾਨੂੰ ਕੀ ਮੁਸ਼ਕਲ ਹੋਈ ਹੋਈ ਹੈ ਜਿਸ ਕਾਰਨ ਉਹ ਫੈਸਲੇ ਲੈਣ 'ਚ ਦੇਰ ਨਹੀਂ ਕਰਦੀ ਉਹ ਜਲਦ ਤੋਂ ਜਲਦ ਪਬਲਿਕ ਦਾ ਹੱਲ ਕਰਵਾ ਦਿੰਦੀ ਜਿਸ ਕਰਕੇ ਪਬਲਿਕ ਨੂੰ ਖੱਜਲ ਨਾ ਹੋਣਾ ਪਵੇ ਕਿ ਉਹ ਆਪਣੇ ਆਪਣੇ ਪੰਜਾਬ ਨੂੰ ਇੱਕ ਸੋਹਣਾ ਪੰਜਾ ਪੰਜਾਬ ਲੈ ਬਣਾ ਸਕੇ ਪੰਜਾਬ ਬਣਾ ਸਕੇ ਇਸ ਲਈ ਰਾਜ ਸਰਕਾਰ ਦਾ ਬਹੁਤ ਹੀ ਅੱਛਾ ਕੰਮ ਹੈ ਪੰਜਾਬ ਦੇ ਵਿੱਚ ਰਾਜ ਸਰਕਾਰ ਨੂੰ ਫੈਸਲੇ ਲੈਣ 'ਤੇ ਜ਼ਿਆਦਾ ਮੁਸ਼ਕਲ ਨਹੀਂ ਹੁੰਦੀ ਧੰਨਵਾਦ